ਸੋ ਅੱਜ ਮੈਂ ਤੁਹਾਨੂੰ ਭਾਰਤ ਦੀਆਂ ਕੁਝ ਐਸੀ ਕਲਾ ਸ਼ੈਲੀਆਂ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਅੱਜ ਕੱਲ੍ਹ ਅਲੋਪ ਹੋ ਰਹੀਆਂ ਹਨ ਜਿਵੇਂ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤਾਂ ਮੈਂ ਆਪਣੇ ਪੰਜਾਬ ਬਾਰੇ ਦੱਸਣਾ ਚਾਹੂੰਗੀ ਪੰਜਾਬ ਵਿੱਚ ਕਾਫੀ ਸਮੇਂ ਤੋਂ ਭੰਗੜਾ ਗਿੱਧਾ ਚੱਲਦਾ ਆ ਰਿਹਾ ਹੈ ਪਰ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਸਭ ਚੀਜ਼ਾਂ ਸਾਨੂੰ ਬਹੁਤ ਹੀ ਘੱਟ ਵੇਖਣ ਨੂੰ ਮਿਲਦੀਆਂ ਸਨ ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਤਾਂ ਉਦੋਂ ਭੰਗੜਾ ਗਿੱਧਾ ਕੋਈ ਵੀ ਤਿਉਹਾਰ ਹੋਵੇ ਜਾਂ ਕਿਸੇ ਦਾ ਜਨਮ ਦਿਨ ਹੋਵੇ ਜਾਂ ਮੇਲਾ ਹੋਵੇ ਤਾਂ ਬਹੁਤ ਹੀ ਸ਼ੌਂਕ ਨਾਲ ਪਾਇਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੇ ਕਲਚਰ ਅਤੇ ਟਰੈਡੀਸ਼ਨ ਵਿੱਚ ਕੋਈ ਵੀ ਇੰਟਰਸਟ ਨਹੀਂ ਲੋਕ ਫੋਰਨ ਕਲਚਰ ਜਾਂ ਵੈਸਟਰਨ ਕਲਚਰ ਨੂੰ ਫੋਲੋ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਪਰ ਆਪਣੇ ਕਲਚਰ ਅਤੇ ਟਰੈਡੀਸ਼ਨ ਨੂੰ ਭੁੱਲ ਕੇ ਉਹ ਇਹ ਸਭ ਚੀਜ਼ਾਂ ਕਰਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਸਾਨੂੰ ਆਪਣੇ ਕਲਚਰ ਅਤੇ ਟਰੈਡੀਸ਼ਨ ਨੂੰ ਫੋਲੋ ਕਰਨਾ ਚਾਹੀਦਾ ਹੈ ਅਤੇ ਜਿਵੇਂ ਕਿ ਮੈਂ ਤੁਹਾਨੂੰ ਆਪਣੇ ਪੰਜਾਬ ਬਾਰੇ ਦੱਸਿਆ ਹੈ ਇਸ ਤਰ੍ਹਾਂ ਭਾਰਤ ਵਿੱਚ ਹੋਰ ਵੀ ਸਟੇਟਸ ਨੇ ਜਿਹਨਾਂ ਵਿੱਚ ਕਈ ਕਲਾ ਸ਼ੈਲੀਆਂ ਹਨ ਜੋ ਕਿ ਅਲੋਪ ਹੋਣ ਲੱਗ ਪਈਆਂ ਹਨ ਇਹਨਾਂ ਨੂੰ ਸੰਭਾਲਣ ਦੀ ਬਹੁਤ ਹੀ ਲੋੜ ਏ ਜਿਵੇਂ ਕੋਈ ਤਿਉਹਾਰ ਹੁੰਦਾ ਹੈ ਦੀਵਾਲੀ ਜਾਂ ਲੋਹੜੀ ਦਿਵਾਲੀ ਦੇ ਸਮੇਂ ਦੀ ਪਹਿਲਾਂ ਲੋਕ ਦੀਵੇ ਬਾਲ ਕੇ ਸਵਾਗਤ ਕਰਦੇ ਸਨ ਪਰ ਅੱਜ ਕੱਲ੍ਹ ਇਹ ਸਭ ਕੁਛ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਲੋਹੜੀ ਹੁੰਦੀ ਸੀ ਤਾਂ ਰਾਤ ਨੂੰ ਲੋਕ ਭੁੱਗਾ ਬਾਲਦੇ ਸਨ ਪਰ ਜੇਕਰ ਅਸੀਂ ਇਹ ਵੀ ਵੇਖੀਏ ਤਾਂ ਇਹ ਵੀ ਖਤਮ ਹੁੰਦਾ ਜਾ ਰਿਹਾ ਸੋ ਸਾਨੂੰ ਆਪਣੇ ਕਲਚਰ ਅਤੇ ਟਰੈਡੀਸ਼ਨ ਨੂੰ ਸੰਭਾਲਣ ਦੀ ਬਹੁਤ ਹੀ ਲੋੜ ਹੈ ਅਤੇ ਸਾਨੂੰ ਆਪਣੇ ਵੱਡਿਆਂ ਦੀਆਂ ਸੁਣਨੀਆਂ ਚਾਹੀਦੀਆਂ ਹਨ ਅਤੇ ਆਪਣੇ ਕਲਚਰ ਅਤੇ ਟਰੈਡੀਸ਼ਨ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ ਹੈ